ਸਤਿ ਸ਼੍ਰੀ ਅਕਾਲ ਜੀ ਮੇਰੀ ਗੱਲ ਹਰਦੀਪ ਸਿੰਘ ਜੀ ਨਾਲ ਹੋ ਰਹੀ ਏ ਹਾਂਜੀ ਮੈਂ ਨਾ ਕਿਸੇ ਦੇ ਘਰ ਆਈ ਸੀ ਮੈਂ ਕਿਸੇ ਕੋਲੋਂ ਪੁੱਛਿਆ ਸੀਗਾ ਅਤੇ ਉਹਨਾਂ ਨੇ ਤੁਹਾਡਾ ਅਡਰੈਸ ਦਿੱਤਾ ਸੀ ਮੈਨੂੰ ਉਹ 'ਚ ਦੱਸਿਆ ਸੀ ਕਿ ਬਾਹਰ ਵਾਘਾ ਬੋਡਰ ਜਾਣਾ ਹੋਵੇ ਤਾਂ ਤੁਸੀਂ ਮੈਨੂੰ ਕੋਈ ਮਾੜਾ ਜਿਹਾ ਅਡਰੈਸ ਦੇ ਸਕਦੇ ਹੋ ਮੈਂ ਭਾਅ ਜੀ ਮੈਂ ਬਾਹਰੋਂ ਆਈ ਹਾਂ ਮੈਂ ਥੋੜ੍ਹਾ ਜਿਹਾ ਨਾ ਬਾਘਾ ਬੋਡਰ ਘੁੰਮਣਾ ਚਾਹੁੰਦੀ ਅਤੇ ਮੈਨੂੰ ਇੱਥੇ ਕੁਛ ਪਤਾ ਨਹੀਂ ਪੰਜਾਬ ਦਾ ਅਤੇ ਮਾੜਾ ਜਿਹਾ ਆਈਡੀਆ ਦੇ ਦਿਓ ਕਿੱਥੇ ਕਰਕੇ ਜਾਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ ਭਾਅ ਜੀ ਹੁਣ ਨਾ ਮੇਰੀ ਕੈਬ ਆ ਗਈ ਆ ਆ ਗਈ ਹੈ ਅਤੇ ਮੈਂ ਜਰਾ ਜਲਦੀ ਜਾਣਾ ਠੀਕ ਹੈ ਭਾਅ ਜੀ ਓਕੇ ਜੀ ਓਕੇ